ਖੇਡਾਂ ਇਸ ਲਈ ਲੋਕਾਂ ਲਈ ਆਂਦਾ ਆਨੰਦਦਾਇਕ ਹਨ ਜਿਵੇਂ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖਣ ਲਈ ਖੇਡਾਂ ਖੇਡਦੇ ਹਾਂ ਅਸੀਂ ਬਚਪਨ ਵਿੱਚ ਵੀ ਖੇਡਾਂ ਖੇਡਦੇ ਸੀ ਜਿਵੇਂ ਕਿ ਕਬੱਡੀ ਖੋ ਖੋ ਹੋ ਗਈ ਹੋਰ ਜਿਵੇਂ ਕਿ ਅਸੀਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਵੀ ਖੇਡਾਂ ਖੇਡਦੇ ਹਾਂ ਜਿਵੇਂ ਕਿ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਲਈ ਵੀ ਖੇਡਾਂ ਖੇਡਦੇ ਹਾਂ ਖੇਡਾਂ ਸਾਨੂੰ ਵੀ ਦੇਖਣ ਵਿੱਚ ਖੁਸ਼ੀ ਮਿਲਦੀ ਹੈ ਅਤੇ ਖੇਡ ਕੇ ਵੀ ਖੁਸ਼ੀ ਮਿਲਦੀ ਹੈ ਖੇਡਾਂ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ ਜਿਵੇਂ ਕਿ ਸਾਡੇ ਦਿਲ ਦੀਆਂ ਬਿਮਾਰੀਆਂ ਸਰੀਰ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦੀਆਂ ਹਨ